ਭੰਗੜਾ ਐਰੋਬਿਕਸ ਵਿੱਚ ਤੁਸ ਹਿੱਸਾ ਲੈਣ ਲਈ ਨਾਲ ਤੁਸੀਂ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਕਿਵੇਂ ਮਹਿਸੂਸ ਕਰਦੇ ਹੋ ਭੰਗੜਾ ਐਰੋਬਿਕਸ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਇਸ ਨਾਲ ਕਲੈਸਟ੍ਰੋਲ ਵੀ ਠੀਕ ਰਹਿੰਦਾ ਹੈ ਭੰਗੜਾ ਐਰੋਬਿਕਸ ਨਾਲ ਮਾਨਸਿਕ ਤਣਾਅ ਠੀਕ ਹੁੰਦਾ ਹੈ ਮਨ ਖੁਸ਼ ਰਹਿੰਦਾ ਹੈ ਸ਼ਾਂਤੀ ਮਿਲਦੀ ਹੈ ਭੰਗੜੇ ਦੀ ਕਲਾਸ ਵਿੱਚ ਜਾ ਕੇ ਸਾਡੇ ਦੋਸਤ ਮਿੱਤਰ ਬਣਦੇ ਹਨ ਜਿਹਨਾਂ ਨਾਲ ਅਸੀਂ ਹੱਸਦੇ ਖੇਡਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਉਸ ਦੇ ਨਾਲ ਵੀ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਲੈਂਦੇ ਹਾਂ ਅਤੇ ਖੁਸ਼ੀ ਦੀ ਖੁਸ਼ੀ ਅਤੇ ਸਰੀਰ ਵੀ ਫਿਟ ਰਹਿੰਦਾ ਹੈ ਅਤੇ ਕੋਈ ਵੀ ਬਿਮਾਰੀ ਸਾਡੇ ਲਾਗੇ ਫਟਕਦੀ ਨਹੀਂ ਆ ਸਾਨੂੰ ਕੋਈ ਜਿੰਮ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ